ਡਰਾਈਵਰ ਸਹੀ ਤਰੀਕੇ ਨਾਲ ਗੱਡੀ ਚਲਾਓ ਜਿਸ ਤਰੀਕੇ ਨਾਲ ਤੁਸੀਂ ਗੱਡੀ ਚਲਾ ਰਹੇ ਹੋ ਇਹ ਤਰੀਕਾ ਕੋਈ ਸਹੀ ਨਹੀਂ ਹੈ ਪਿੱਛੇ ਵੀ ਤੁਸੀਂ ਇੱਕ ਐਕਸੀਡੈਂਟ ਕੀਤਾ ਹੈ ਔਰ ਪੁਲਿਸ ਤੋਂ ਬਚਦੇ ਬਚਦੇ ਅਸੀਂ ਬਚੇ ਹਾਂ ਹੁਣ ਤੁਸੀਂ ਮੇਰੀ ਬੱਸ ਵੀ ਛੁਡਾ ਦੇਣੀ ਹੈ ਔਰ ਤੁਸੀਂ ਗੰਦੀ ਲੈਂਗੁਏਜ ਯੂਜ਼ ਕਰ ਰਹੇ ਹੋ ਇਹ ਸਾਰੇ ਡਰਾਈਵਿੰਗ ਦੇ ਰੂਲਸ ਦੇ ਖਿਲਾਫ਼ ਹੈ ਔਰ ਅਗਰ ਤੁਸੀਂ ਇਸੇ ਤਰੀਕੇ ਨਾਲ ਗੱਡੀ ਚਲਾਓਗੇ ਤਾਂ ਮੈਂ ਤੁਹਾਨੂੰ ਕੋਈ ਕਿਰਾਇਆ ਨਹੀਂ ਦੇਣਾ ਔਰ ਤੁਹਾਡੀ ਸ਼ਿਕਾਇਤ ਵੀ ਤੁਹਾਡੇ ਏਜੰਸੀ ਵਾਲਿਆਂ ਨਾਲ ਕਰ ਦੇਣੀ ਹੈ ਬਿਲਕੁਲ ਇਹੋ ਜਿਹੀ ਲੈਂਗੁਏਜ ਯੂਜ਼ ਨਹੀਂ ਕਰਨੀ ਨਾ ਹੀ ਮੈਂ ਬਰਦਾਸ਼ਤ ਕਰਨੀ ਆ ਇਹ ਕੋਈ ਤਰੀਕਾ ਨਹੀਂ ਹੈ ਇੱਕ ਆਪਣੇ ਪਸੈਂਜਰ ਦੇ ਨਾਲ ਗੱਲ ਕਰਨ ਦਾ ਔਰ ਤੁਸੀਂ ਇਹ ਬਿਹੇਵ ਵੀ ਗਲਤ ਕਰ ਰਹੇ ਹੋ ਇੱਕ ਤੁਸੀਂ ਡਰਿੰਕ ਵੀ ਕੀਤੀ ਹੋਈ ਹੈ ਔਰ ਡਰਿੰਕ ਕਰਕੇ ਡ ਡਰਾਈਵਿੰਗ ਕਰਨੀ ਇਹ ਤੇ ਵੈਸੇ ਰੂਲਸ ਤੋਂ ਖਿਲਾਫ਼ ਹੈ ਇਹਦੀ ਮੈਂ ਤੁਹਾਡੀ ਰਿਪੋਰਟ ਵੀ ਪੁਲਿਸ 'ਚ ਕਰ ਸਕਦੀ ਹਾਂ ਅਗਰ ਤੁਸੀਂ ਸਹੀ ਤਰੀਕੇ ਨਾਲ ਨਾ ਤੁਸੀਂ ਗੱਡੀ ਚਲਾਈ ਤੇ ਹੁਣ ਤੁਸੀਂ ਟਿਕਾਣੇ 'ਤੇ ਪਹੁੰਚਾ ਕੇ ਵੀ ਤੁਸੀਂ ਮੇਰੀ ਬਸ ਮਿਸ ਕਰਵਾ ਦਿੱਤੀ ਆ ਹੁਣ ਮੇਰਾ ਜਿਹੜਾ ਨੁਕਸਾਨ ਹੋਇਆ ਕੌਣ ਭਰੇਗਾ ਹੁਣ ਮੈਨੂੰ ਦੂਸਰੀ ਬੱਸ ਲੈਣੀ ਪਏਗੀ ਉਹ ਦੂਸਰੀ ਬਸ ਲੈਣ ਵਾਸਤੇ ਮੈਨੂੰ ਕਿੰਨਾ ਟਾਈਮ ਵੇਸਟ ਕਰਨਾ ਪਏਗਾ ਮੇਰਾ ਟਾਈਮ ਵੇਸਟ ਹੋ ਗਿਆ ਮੈਂ ਆਪਣੀ ਜਗ੍ਹਾ 'ਤੇ ਟਿਕਾਣੇ 'ਤੇ ਨਹੀਂ ਪਹੁੰਚਣਾ ਉੱਥੇ ਉੱਥੋਂ ਦਾ ਜਿਹੜਾ ਮੇਰਾ ਨੁਕਸਾਨ ਹੋਇਆ ਉਹ ਅਲੱਗ ਜਿਹੜਾ ਪੁਲਿਸ ਦੇ ਨਾਲ ਗੱਲਬਾਤ ਹੋਈ ਆ ਉਹ ਅਲੱਗ ਮੈਂ ਕੁਛ ਵੀ ਬਰਦਾਸ਼ਤ ਨਹੀਂ ਕਰਨਾ ਮੈਂ ਤੁਹਾਡੀ ਆ ਸ਼ਿਕਾਇਤ ਏਜੰਸੀ ਨੂੰ ਕਰਨੀ ਹੀ ਕਰਨੀ ਹੈ ਮੈਂ ਉਹਨਾਂ ਨੂੰ ਡਾਇਲ ਕਰ ਰਹੀ ਹਾਂ ਨੰਬਰ ਮੈਂ ਉਹਨਾਂ ਨਾਲ ਗੱਲ ਕਰਕੇ ਹੀ ਤੁਹਾਨੂੰ ਕਿਰਾਇਆ ਦੇਣਾ ਹੈ ਅਦਰਵਾਈਜ਼ ਮੈਂ ਨਹੀਂ ਦੇਣਾ ਹਾਂਜੀ ਭਾਅ ਜੀ ਮੈਂ ਤੁਹਾਡੇ ਐਹ ਡਰਾਈਵਰ ਦੇ ਨਾਲ ਇੱਥੇ ਬੱਸ ਸਟੈਂਡ ਤੱਕ ਆਈ ਹਾਂ ਪਰ ਉਹ ਡਰਾਈਵਰ ਬਹੁਤ ਹੀ ਬਤਮੀਜ਼ ਹੈ ਉਤ ਇੱਕ ਤਾਂ ਉਹਦਾ ਬਹੁਤ ਐਟੀਟਿਊਡ ਗੰਦਾ ਹੈ ਬੜੇ ਗਲਤ ਤਰੀਕੇ ਨਾਲ ਗੱਲ ਕਰ ਰਿਹਾ ਔਰ ਵਿੱਚ ਅਬਿਊਜਿੰਗ ਲੈਂਗੂਏਜ ਵੀ ਯੂਜ਼ ਕਰ ਰਿਹਾ ਰਾਹ ਜਾਂਦਿਆਂ ਨੂੰ ਵੀ ਔਰ ਗਾਲਾਂ ਕੱਢ ਰਿਹਾ ਮੇਰੇ ਨਾਲ ਵੀ ਉਹਨੇ ਬਤਮੀਜੀ ਕੀਤੀ ਹੈ ਦੋ ਤਿੰਨ ਜਗ੍ਹਾ ਤੋਂ ਉਹਨੇ ਟ੍ਰੈਫਿਕ ਦੇ ਰੂਲਸ ਵੀ ਫੋਲੋ ਨਹੀਂ ਕੀਤੇ ਜਿਹਦੇ ਕਾਰਨ ਸਾਨੂੰ ਬੜੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਇੱਕ ਵਾਰੀ ਪੁਲਿਸ ਨੇ ਵੀ ਫੜ ਲਿਆ ਇਹਨੂੰ ਇੱਕ ਐਕਸੀਡੈਂਟ ਕੀਤਾ ਉੱਥੇ ਵੀ ਕਿੰਨੇ ਲੋਕ ਇਕੱਠੇ ਹੋ ਗਏ ਉਹਨਾਂ ਨੇ ਵੀ ਇਹਨੂੰ ਸਮਝਾਇਆ ਪੁਲਿਸ ਨਾਲ ਸ ਕਿੰਨੀ ਬਹਿਸਬਾਜੀ ਹੋਈ ਹੈ ਇਹਨੇ ਕੀਤੀ ਹੈ ਕੋਈ ਇਹਨੇ ਮਾਫ਼ੀ ਨਹੀਂ ਮੰਗੀ ਕੋਈ ਉਹਨਾਂ ਦਾ ਕਹਿਣਾ ਨਹੀਂ ਮੰਨਿਆ ਮਸਾ ਹੀ ਉਹਨਾਂ ਕੋਲੋਂ ਛੁਡਾ ਕੇ ਮੈਂ ਅੱਗੇ ਲੈ ਕੇ ਆਈ ਹਾਂ ਕਿ ਮੈਨੂੰ ਜ਼ਰੂਰੀ ਸੀ ਕੰਮ ਸੀ ਮੈਂ ਜਾਣਾ ਮੈਨੂੰ ਤੁਸੀਂ ਟਿਕਾਣੇ 'ਤੇ ਛੱਡੋ ਫਿਰ ਰਸਤੇ ਵਿੱਚ ਨੇ ਇਹਨੇ ਬੜੀ ਇੰਨੀ ਗੰਦੀ ਡਰਾਈਵਿੰਗ ਕੀਤੀ ਹੈ ਕੋਈ ਰੂਲਸ ਫੋਲੋ ਨਹੀਂ ਕਰ ਰਿਹਾ ਕਦੀ ਸਲੋ ਕਰ ਲੈਂਦਾ ਕਦੀ ਫਾਸਟ ਕਰਦਾ ਜੇ ਮੈਂ ਉੱਥੇ ਇਹਨੂੰ ਮਨ੍ਹਾਂ ਕਰ ਰਹੀ ਹਾਂ ਔਰ ਉਹ ਮੇਰੀ ਗੱਲ ਕੋਈ ਵੀ ਨਹੀਂ ਮੰਨ ਰਿਹਾ ਔਰ ਉੱਤੋਂ ਮੇਰੇ ਨਾਲ ਇਹ ਗਲਤ ਬਿਹੇਵ ਕਰ ਰਿਹਾ ਹੁਣ ਮੈਂ ਇਨੇ ਇਹਨੇ ਮੈਨੂੰ ਲੇਟ ਪਹੁੰਚਾਇਆ ਔਰ ਲੇਟ ਪਹੁੰਚਾਉਣ ਦੇ ਕਾਰਨ ਮੇਰੀ ਬੱਸ ਵੀ ਨਿਕਲ ਗਈ ਹੈ ਔਰ ਜਿੱਥੇ ਮੈਂ ਟਿ ਪਹੁੰਚਣਾ ਸੀ ਮੇਰੀ ਬਹੁਤ ਜ਼ਰੂਰੀ ਮੀਟਿੰਗ ਸੀ ਮੇਰਾ ਕੰਮ ਸੀ ਮੇਰਾ ਉਹ ਸਾਰਾ ਨਿਕਲ ਗਿਆ ਕੰਮ ਇਸ ਤਰ੍ਹਾਂ ਹੁਣ ਮੈਂ ਦੂਸਰੀ ਬੱਸ ਲਵਾਂਗੀ ਮੇਰਾ ਉੱਥੇ ਦਾ ਜਿਹੜਾ ਕੰਮ ਰਹਿ ਗਿਆ ਉਹਦਾ ਮੈਨੂੰ ਅਲੱਗ ਫਾਈਨ ਪਏਗਾ ਜਾਂ ਮੇਰੇ ਕੰਮ ਖ਼ਰਾਬ ਹੋਏਗਾ ਉਹ ਅਲੱਗ ਗੱਲ ਹੈ ਉਹ ਜਿਹੜਾ ਇਹ ਬਤਮੀਜ਼ੀ ਮੇਰੇ ਨਾਲ ਕਰ ਰਿਹਾ ਇਹਦਾ ਕੌਣ ਇਹਦਾ ਹਰਜ਼ਾਨਾ ਭਰੇਗਾ ਮੈਂ ਨਾ ਤਾਂ ਇਹਨੂੰ ਕਿਰਾਇਆ ਦੇਣਾ ਔਰ ਤੁਹਾਨੂੰ ਮੈਂ ਇਹੀ ਸੁਜੈਸਟ ਕਰਾਂਗੀ ਕਿ ਇਹੋ ਇਹੋ ਜਿਹੇ ਜਿਹੜੇ ਡਰਾਈਵਰ ਤੁਸੀਂ ਰੱਖੇ ਹੋਏ ਆ ਇਹਨਾਂ ਨੂੰ ਆਪਣੀ ਨੌਕਰੀ ਤੋਂ ਕੱਢੋ ਤਾਂ ਕਿ ਤੁਹਾਡੇ ਜਿਹੜੇ ਪਸੈਂਜਰ ਹੈ ਉਹ ਕੰਫਰਟੇਬਲ ਫੀਲ ਕਰਨ ਤਾਂ ਕਿ ਤੁਹਾਡੇ ਆਪਣੇ ਏਜੰਸੀ ਵੀ ਹੋਰ ਤਰੱਕੀ ਕਰੇ ਅਗਰ ਇਸ ਤਰ੍ਹਾਂ ਦੇ ਡਰਾਈਵਰ ਤੁਸੀਂ ਰੱਖੋਂਗੇ ਤੁਹਾਡੀ ਕੰਪਨੀ ਬੰਦ ਹੋ ਜਾਏਗੀ ਕਿਉਂਕਿ ਬਹੁਤ ਕੰਪਲੇਂਟਸ ਹੈਗੀਆਂ ਇਸ ਡਰਾਈਵਰ ਦੀਆਂ ਅੱਛੇ ਡਰਾਈਵਰ ਰੱਖੋ ਜਿਹੜੇ ਨਸ਼ਾ ਨਾ ਕਰਨ ਆਰਾਮ ਨਾਲ ਡਰਾਈਵਿੰਗ ਕਰਨ ਅੱਛੀ ਲੈਂਗੁਏਜ ਯੂਜ਼ ਕਰਨ ਟ੍ਰੈਫਿਕ ਰੂਲਸ ਨੂੰ ਫੋਲੋ ਕਰਨ ਔਰ ਸਹੀ ਤਰੀਕੇ ਦੇ ਨਾਲ ਕਸਬ ਆਪਣੇ ਪੈਸੈਂਜਰ ਦੇ ਨਾਲ ਬਿਹੇਵ ਕਰਨ ਥੈਂਕ ਯੂ ਜੀ